ਪੰਜਾਬੀ ਭਾਸ਼ਾ ਮੈਨੂੰ ਇਸ 'ਤੇ ਬਹੁਤ ਮਾਣ ਹੈ ਮੈਨੂੰ ਪੰਜਾਬੀ ਹੋਣ 'ਤੇ ਹੀ ਮਾ ਮਾਣ ਹੈ ਪੰਜਾਬੀ ਭਾਸ਼ਾ ਮੇਰੀ ਮਾਤ ਭਾਸ਼ਾ ਇਹ ਇਹਨੇ ਇੱਕ ਵੱਖਰਾ ਹੀ ਵਖਰੇਵਾਂ ਹੈ ਜਿਹੜਾ ਸਾਨੂੰ ਉਹ ਦਿੱਤਾ ਜੇ ਅਸੀਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਵੀ ਜਿਵੇਂ ਕਨੇਡਾ ਵਰਗੇ ਦੇਸ਼ ਨੇ ਉੱਥੇ ਵੀ ਇਸ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਬਹੁਤ ਮਾਣ ਮਹਿਸੂਸ ਹੁੰਦਾ ਪੰਜਾਬੀ ਹੋਣ 'ਤੇ